ਮੈਂ ਕਦੇ ਕੋਈ ਮੂਰਤੀ ਕਲਾ ਵ ਕਦੇ ਨਹੀਂ ਬਣਾਈ ਅਤੇ ਨਾ ਹੀ ਬਣਾਉਣੀ ਆ ਕਿਉਂਕਿ ਸਾਡੇ ਮੈਂ ਸਿੱਖ ਧਰਮ ਨਾਲ ਸਬੰਧ ਰੱਖਦਾਂ ਅਤੇ ਸਾਡੇ ਗੁਰੂ ਨਾਨਕ ਦੇ ਘਰ ਨੇ ਗੁਰੂ ਨਾਨਕ ਦੀ ਜਿਹੜੀ ਗੁਰਦੇਵ ਜੀ ਦੀ ਫਿਲੋਸਫੀ ਆ ਉਹ ਮੂਰਤੀ ਪੂ ਪੂਜਾ ਦਾ ਬੁਰੀ ਤਰ੍ਹਾਂ ਨਾਲ ਖੰਡਨ ਕਰਦੀ ਇਸ ਕਰਕੇ ਮੇਰਾ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਜਿਹੜਾ ਇਹ ਮੂਰਤੀ ਕਲਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਪਾਖੰਡ ਹੈਗਾ ਸਾਨੂੰ ਤਾਂ ਨਿਰੰਕਾਰ ਦੇ ਨਾਲ ਹੀ ਜੋੜਿਆ ਗਿਆ